ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੈਂ ਸਿਮਰਨ ਦੀ ਮੰਮਾ ਬੋਲ ਰਹੀ ਹਾਂ ਹਾਂਜੀ ਹਾਂਜੀ ਠੀਕ ਹੈ ਮੈਡਮ ਅਤੇ ਹਾਂਜੀ ਮੈਡਮ ਮੈਂ ਹੁਣੇ ਦਸ ਮਿੰਨਟ 'ਚ ਆ ਕੇ ਉਹਨੂੰ ਲੈ ਜਾਂਦੀ ਹਾਂ ਤੁਸੀਂ ਉਹਨੂੰ ਥੋੜ੍ਹਾ ਜਿਹਾ ਜੂਸ ਵਗੈਰਾ ਪਿਆ ਦਿਉ ਤੁਹਾਡੇ ਜਿੰਨੇ ਵੀ ਪੈਸੇ ਬਣਨਗੇ ਮੈਂ ਆਣ ਕੇ ਦੇ ਦੂੰਗੀ ਥੋੜ੍ਹਾ ਜਿਹਾ ਉਹਦਾ ਧਿਆਨ ਰੱਖੋ ਮੈਂ ਦਸ ਮਿੰਨਟ ਤੱਕਰ ਆਣ ਕੇ ਅਤੇ ਉਹਨੂੰ ਲੈ ਜਾਂਦੀ ਹਾਂ ਠੀਕ ਹੈ ਮੈਡਮ ਥੈਂਕ ਯੂ ਜੀ ਧੰਨਵਾਦ ਜੀ